ਮੈਂ ਅੰਮ੍ਰਿਤਸਰ ਵਿਖੇ ਰਹਿੰਦਾ ਹਾਂ ਇੱਥੇ ਮੁੱਖ ਤੌਰ 'ਤੇ ਜੋ ਧਾਰਮਿਕ ਅਸਥਾਨ ਹੈ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਪਰੰਤੂ ਉੱਥੇ ਮੈਂ ਮਹੀਨੇ ਜਾਂ ਦੋ ਮਹੀਨੇ ਬਾਅਦ ਹੀ ਮੈਂ ਮੱਥਾ ਟੇਕਣ ਜਾਂਦਾ ਹਾਂ ਯੂਨੀਵਰਸਿਟੀ ਦੇ ਵਿੱਚ ਮੇਰਾ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਮੈਂ ਲਗਭਗ ਹਰ ਹਫਤੇ ਚਲਾ ਜਾਂਦਾ ਹਾਂ ਉੱਥੇ ਬੈਠ ਕੇ ਮੇਰਾ ਮੁੱਖ ਮੇਰਾ ਜੋ ਕੰਮ ਹੁੰਦਾ ਹੈ ਕਿ ਮੱਥਾ ਟੇਕਣ ਤੋਂ ਬਾਅਦ ਮੈਂ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਬੈਠ ਜਾਂਦਾ ਹਾਂ ਅਤੇ ਜੋ ਰਸ ਭਿੰਨਾ ਕੀਰਤਨ ਹੋ ਰਿਹਾ ਹੁੰਦਾ ਹੈ ਉਸ ਦਾ ਅਨੰਦ ਮਾਣਦਾ ਹਾਂ ਇਸ ਨਾਲ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਤੇ ਡੇਲੀ ਰੂਟੀਨ ਤੋਂ ਜੋ ਡੇਲੀ ਤੁਹਾਡੀ ਦਿਨ ਚਰਿਆ ਹੈ ਉਸ ਤੋਂ ਹੱਟ ਕੇ ਤੁਹਾਨੂੰ ਇੱਕ ਵੱਖਰੇ ਆਨੰਦ ਦੀ ਪ੍ਰਾਪਤੀ ਦਾ ਮਹਿਸੂਸ ਪ੍ਰਾਪਤੀ ਮਹਿਸੂਸ ਹੁੰਦੀ ਹੈ ਅਤੇ ਇਸ ਤਰ੍ਹਾਂ ਦਾ ਕੰਮ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਹਦੇ ਨਾਲ ਬੰਦਾ ਜੋ ਤੁਹਾਨੂੰ ਵੱਖ ਵੱਖ ਤਰ੍ਹਾਂ ਦੀਆਂ ਸਟਰੈੱਸ ਜਾਂ ਟੈਨਸ਼ਨ ਨਾਲ ਸੰਬੰਧਿਤ ਜੋ ਗਤੀਵਿਧੀਆਂ ਹਨ ਉਹਨਾਂ ਤੋਂ ਤੁਹਾਨੂੰ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ